ਉਂਝ ਤਾਂ ਸਾਡੇ ਸ਼ਹਿਰ ਵਿੱਚ ਬਹੁਤ ਸਾਰੇ ਡੋਕਟਰ ਹਨ ਪਰ ਸਾਡੇ ਇਲਾਕੇ ਵਿੱਚ ਕੁਛ ਚਾਰ ਪੰਜ ਡੋਕਟਰ ਹਨ ਜੋ ਕਿ ਬਹੁਤ ਵਧੀਆ ਹਨ ਸਾਡੇ ਵਿੱਚ ਜਦੋਂ ਵੀ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਅਸੀਂ ਓਹਨਾਂ ਕੋਲੋ ਹੀ ਦਵਾਈ ਲੈ ਕੇ ਆਂਦੇ ਹਾਂ ਓਹ ਬਹੁਤ ਹੀ ਵਧੀਆ ਦਵਾਈ ਦਿੰਦੇ ਹਨ ਜਿਸ ਨਾਲ ਥੋੜ੍ਹੇ ਸਮੇਂ ਵਿੱਚ ਹੀ ਸਾਡੀ ਸਿਹਤ ਬਹੁਤ ਵਧੀਆ ਹੋ ਜਾਂਦੀ ਹੈ ਉਹਨਾਂ ਵਿੱਚੋਂ ਕੁਛ ਕੁ ਮੇਰੇ ਮਿੱਤਰ ਹਨ ਜੋ ਕਿ ਸਾਨੂੰ ਬਹੁਤ ਹੀ ਵਧੀਆ ਸਲਾਹ ਦਿੰਦੇ ਹਨ ਅਤੇ ਸਿਹਤ ਨੂੰ ਵਧੀਆ ਰੱਖਣ ਦੇ ਬਹੁਤ ਹੀ ਚੰਗੇ ਚੰਗੇ ਤਰੀਕੇ ਦੱਸਦੇ ਹਨ ਸਾਡੇ ਲਾਗੇ ਵਾਲੇ ਮੈਡੀਕਲ ਕੋਲਜ ਵਿੱਚ ਕਈ ਬੱਚੇ ਪੜ੍ਹਦੇ ਹਨ ਜੋ ਕਿ ਮੈਡੀਕਲ ਨਾਲ ਰਿਲੇਟਿਡ ਸਟੱਡੀ ਕਰਦੇ ਹਨ ਉੱਥੇ ਬੱਚਿਆਂ ਨੂੰ ਨਰਸਿੰਗ ਜੀ ਐੱਨ ਐੱਮ ਐੱਮ ਡੀ ਸਰਜਨ ਆਦਿ ਵਰਗੀ ਸਿੱਖਿਆ ਦਿੱਤੀ ਜਾਂਦੀ ਹੈ ਜਿੱਥੇ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਦੇ ਹਨ ਅਤੇ ਇਸ ਪੱਧਰ ਵਿੱਚ ਸ਼ਾਮਿਲ ਹੁੰਦੇ ਹਨ ਉਹ ਬਹੁਤ ਹੀ ਵਧੀਆ ਡੋਕਟਰ ਹਨ ਔਰ ਮੈਂ ਜਦੋਂ ਵੀ ਮੈਨੂੰ ਲੋੜ ਪੈਂਦੀ ਹੈ ਤਾਂ ਮੈਂ ਆਪਣੇ ਉਹਨਾਂ ਦੋਸਤਾਂ ਕੋਲ ਜਾਂਦੀ ਹਾਂ ਅਤੇ ਉਹਨਾਂ ਨੂੰ ਆਪਣੀ ਮੁਸ਼ਕਿਲ ਦੱਸਦੀ ਹਾਂ ਉਹ ਮੈਨੂੰ ਬੜੇ ਹੀ ਵਧੀਆ ਤਰੀਕੇ ਨਾਲ ਹਰ ਪਰੇਸ਼ਾਨੀ ਦਾ ਹੱਲ ਦੱਸ ਦਿੰਦੇ ਹਨ ਅਤੇ ਉਹ ਸਾਡੀ ਸਿਹਤ ਨੂੰ ਵਧੀਆ ਰੱਖਣ ਦੇ ਵੱਖ ਵੱਖ ਤਰੀਕੇ ਵੀ ਦੱਸਦੇ ਹਨ ਕਿਵੇਂ ਸ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਮੇਰਾ ਸਾਰਾ ਪਰਿਵਾਰ ਜਦੋਂ ਵੀ ਅਸੀਂ ਕਿਸੇ ਵੀ ਸਿਹਤ ਦੀ ਬਿਮਾਰੀ ਵਿੱਚ ਹੁੰਦੇ ਹਾਂ ਤਾਂ ਅਸੀਂ ਉਹਨਾਂ ਕੋਲ ਜਾਂਦੇ ਹਾਂ ਉਹ ਸਾਨੂੰ ਬੜੇ ਹੀ ਵਧੀਆ ਤਰੀਕੇ ਨਾਲ ਟ੍ਰੀਟ ਕਰਦੇ ਹਨ ਧੰਨਵਾਦ